ਹੈਲੋ ਹਾਂਜੀ ਤੁਸੀਂ ਸੁਨਿਆਰੇ ਤੋਂ ਬੋਲਦੇ ਹੋ ਠੀਕ ਹੈ ਕਿੱਥੇ ਦੁਕਾਨ ਹੈ ਜੀ ਤੁਹਾਡੀ ਅੱਛਾ ਠੀਕ ਹੈ ਮੇਰੇ ਨਾ ਮੈਰਿਜ ਰੱਖੀ ਹੋਈ ਆ ਅਤੇ ਤੁਸੀਂ ਮੈਂ ਤੁਹਾਡੇ ਕੋਲੋਂ ਗਹਿ ਗਹਿਣੇ ਬਣਵਾਉਣੇ ਆ ਇੱਕ ਤਾਂ ਕਾਂਟੇ ਇੱਕ ਹਾਰ ਪਾਇਲ ਸੈੱਟ ਇੱਕ ਦੋ ਮੁੰਦਰੀਆਂ ਬਣਵਾਉਣੀਆਂ ਡਿਜਾਇਨ ਤਾਂ ਸਾਡੇ ਕੋਲ ਤੁਹਾਡੇ ਤੁਹਾਡੇ ਡਿਜ਼ਾਇਨ ਤੁਸੀਂ ਐਲਬਮ ਉਹਦੇ ਉੱਤੇ ਹੋਊਗੀ ਅਸੀਂ ਵੇਖ ਲਵਾਂਗੇ ਇੱਕ ਸਾਡੀ ਸੱਸ ਵਾਸਤੇ ਮੁੰਦਰੀ ਕਰਵਾਉਣੀ ਆ ਤਾਂ ਉਹ ਜੇ ਹਿਸਾਬ ਬਜ਼ੁਰਗਾਂ ਦੇ ਹਿਸਾਬ ਤੁਸੀਂ ਬਣਾ ਦੇ ਇੱਕ ਚੂੜੀ ਬਣਵਾਉਣੀ ਹਾਂ ਅਤੇ ਸੋ ਬਾਕੀ ਹਾਂ ਚਾਂਦੀ ਦੇ ਗਹਿਣੇ ਵੀ ਹੈਗੀ ਤੁਹਾਡੇ ਕੋਲ ਅਤੇ ਚਾਂਦੀ ਪੰਜੇਬਾਂ ਪੰਜੇਬਾਂ ਪੰਜੇਬਾਂ ਪੰਜੇਬਾਂ ਪ ਪੈਰਾਂ ਦੀਆਂ ਝਾਂਜਰਾ ਬੋਲਦੇ ਜਿਸਨੂੰ ਹਾਂ ਅਤੇ ਬਾਕੀ ਦਾ ਚਾਂਦੀ ਦਾ ਕੀ ਤੁਹਾਡੇ ਕੋਲ ਰੇਟ ਹੈ ਪੰਜਾਹ ਹਜ਼ਾਰ ਤਾਂ ਬਹੁਤ ਜ਼ਿਆਦੇ ਸੋਨੇ ਦਾ ਕੀ ਰੇਟ ਆ ਹੁਣ ਸੋਨੇ ਦਾ ਕੀ ਰੇਟ ਹੈ ਠੀਕ ਹੈ ਅਤੇ ਚਲੋ ਅਸੀਂ ਤੁਹਾਡੇ ਪੱਕੇ ਗਾਹਕ ਹੈਗੇ ਹਾਂ ਤੁਸੀਂ ਸਾਡੇ ਨਾਲ ਕੁਛ ਲੈੱਸ ਲੁਸ ਕਰ ਲਓਗੇ ਹਾਂ ਦੱਸੋ ਇੱਕ ਨਾ ਅਸੀਂ ਆਹਾ ਨੱਥ ਨੂੰ ਬਣਵਾਉਣੀ ਆ ਕੋ ਕੋਕਾ ਨੱਥ ਜਿਸਨੂੰ ਕਹਿ ਦਿੰਦੇ ਹਾਂ ਕੋਕਾ ਇੱਕ ਝੂਮਰ ਸੂਈ ਸੋਨੇ ਦੇ ਤਾਂ ਦੋ ਚਾਰ ਤੋਲੇ ਬਣਾਉਣੇ ਪੈਣਗੇ ਪਰ ਵਧੀਆ ਘੜਤ ਹੋਵੇ ਕੋਈ ਉਲਾਂਭੇ ਵਾਲੀ ਗੱਲ ਨਾ ਉਲਾਂਭੇ ਵਾਲੀ ਗੱਲ ਨਾ ਹੋਵੇ

ਠੀਕ ਆ ਚਲੋ ਚਾਂਦੀ ਦੀ ਚਾਹੀਦੀ ਹੈ ਅਤੇ ਹੋਰ ਬਾਕੀ ਤਾਂ ਹੋਰ ਝੂੰਮਰ ਸੂਈ ਟਿੱਕਾ ਜੀ ਕਾਫੀ ਬਣਵਾਉਣਾ ਅਸੀਂ

ਟਿੱਕਾ ਜੀ ਤੋਲੇ ਕੁ ਦਾ ਚਾਹੀਦਾ ਸਾਨੂੰ ਇੱਕ ਤੋਲੇ ਦਾ ਠੀਕ ਆ ਡਿਜਾਇਨ ਆ ਕਾਂਟੇ ਕਾਂਟੇ ਵੈਸੇ ਤੁਸੀਂ ਕਿੰਨੇ ਤੋਲੇ ਦਾ ਬਣਾਂ ਦਿੰਦੇ ਕਾਂਟੇ ਕਾਂਟੇ ਕਿੰਨੇ ਤੋਲੇ ਦਾ ਬਣਵਾਉਣੇ ਆ ਤੋਲੇ ਦੇ ਤੋਲੇ ਦੇ ਤੋਂ ਕਮ ਹੋਵੇ ਸਵਾ ਕੁ ਤੋਲੇ ਤੱਕ ਬਣਾ ਦਿਓਗੇ ਠੀਕ ਹੈ ਅਤੇ ਬਾਕੀ ਦਾ ਹਾਰ ਬਣਵਾਉਣਾ ਹਾਂਜੀ ਹਾਂਜੀ ਚਬੂਲੀ ਵਾਲੇ ਬਣਵਾਉਣੇ ਆ ਹਾਂ ਜੋ ਅੱਜ ਬਾਕੀ ਦਾ ਤੁਸੀਂ ਜੋ ਸੈੱਟ ਦੇ ਨਾਲ ਡਿਜਾਇਨ ਹੋਇਆ ਮੁੰਦਰੀ ਦਾ ਛਾਪ ਦਾ ਉਹਦੇ ਨਾਲ ਦਾ ਪੂਰਾ ਸੈੱਟ ਤੁਹਾਨੂੰ ਅਸੀਂ ਤੁਸੀਂ ਸਾਡੇ ਜਿਹੜੇ ਤੁਹਾਡੇ ਬਣਾਏ ਹੁੰਦੇ ਐਲਬਮ ਰੱਖੇ ਹੁੰਦੀ ਆ ਫੋਟੋ ਖਿੱਚੀ ਹੁੰਦੀ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਅਸੀਂ ਸਾਡੇ ਪਸੰਦ ਆ ਗਏ ਤਾਂ ਅਸੀਂ ਦੁਕਾਨ 'ਤੇ ਤੁਹਾਨੂੰ ਸਾਈ ਫੜਾ ਜਾਵਾਂਗੇ ਤਾਂ ਤੁਸੀਂ ਸਾਨੂੰ ਬਣਾ ਠੀਕ ਠੀਕ ਆ ਓਕੇ ਆ